ਜਿਸ ਤਰ੍ਹਾਂ ਅੱਜ ਕੱਲ੍ਹ ਟੈਕਨੋਲੋਜੀ ਦਾ ਯੂਜ ਵੱਧ ਰਿਹਾ ਹੈ ਆਪਾਂ ਸਾਰਾ ਦਿਨ ਕੰਪਿਊਟਰ ਲੈਪਟੋਪ ਜਾਂ ਮੋਬਾਈਲ ਦੇ ਉੱਪਰ ਕੰਮ ਕਰਦੇ ਹਾਂ ਅਤੇ ਆਪਣਾ ਸਰੀਰਕ ਗਤੀਵਿਧੀਆਂ ਘੱਟ ਗਈਆਂ ਹਨ ਜਿਸ ਕਰਕੇ ਆਪਣਾ ਭਾਰ ਵੱਧਦਾ ਹੈ ਤਾਂ ਸਰੀਰਕ ਗਤੀਵਿਧੀਆਂ ਨੂੰ ਵਧਾਉਣ ਦੀ ਜ਼ਰੂਰਤ ਹੈ ਇਸ ਲਈ ਅਸੀਂ ਆਪਣੇ ਪਿੰਡ ਵਿੱਚ ਇੱਕ ਹੈਲਥ ਕਲੱਬ ਬਣਾਇਆ ਹੋਇਆ ਹੈ ਜਿਸ ਵਿੱਚ ਅਸੀਂ ਸਾਰੇ ਮੈਂਬਰ ਸਵੇਰੇ ਸੈਰ 'ਤੇ ਜਾਂਦੇ ਹਾਂ ਔਰ ਸੈਰ ਦਾ ਮਤਲਬ ਇਹ ਨਹੀਂ ਕਿ ਅਸੀਂ ਸਿਰਫ ਚੱਲਣਾ ਹੈ ਸੈਰ ਦਾ ਮਤਲਬ ਇਹ ਹੈ ਕਿ ਅਸੀਂ ਇੱਕ ਤੇਜ਼ ਗਤੀ ਵਿੱਚ ਚੱਲਣਾ ਹੈ ਕਿ ਸਾਡੇ ਸਰੀਰ ਦਾ ਵੱਧ ਤੋਂ ਵੱਧ ਉਪਯੋਗ ਹੋਵੇ ਅਤੇ ਸੈਰ ਕਰਨ ਤੋਂ ਬਾਅਦ ਅਸੀਂ ਯੋਗਾ ਵੀ ਕਰਦੇ ਹਾਂ ਯੋਗਾ ਸਾਡੀ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ ਅਤੇ ਯੋਗਾ ਆਪਾਂ ਨੂੰ ਬਾਹਰੀ ਅਤੇ ਅੰਦਰੂਨੀ ਬਿਮਾਰੀਆਂ ਤੋਂ ਬਚਾਉਂਦਾ ਹੈ ਅਗਰ ਅਸੀਂ ਗਲਤ ਢੰਗ ਨਾਲ ਯੋਗਾ ਕਰਦੇ ਹਾਂ ਤਾਂ ਸਾਨੂੰ ਕੁਝ ਨੁਕਸਾਨ ਵੀ ਹੋ ਸਕਦੇ ਹਨ ਤਾਂ ਆਪਾਂ ਨੂੰ ਇੱਕ ਮਾਹਰ ਦੀ ਜ਼ਰੂਰਤ ਹੁੰਦੀ ਹੈ ਇਸ ਲਈ ਅਸੀਂ ਪਿੰਡ ਵਿੱਚ ਇੱਕ ਮਾਹਰ ਵੀ ਅਰੇਂਜ ਕੀਤਾ ਹੋਇਆ ਹੈ ਜੋ ਸਾਨੂੰ ਯੋਗਾ ਦੇ ਸਹੀ ਜਾਣਕਾਰੀ ਦਿੰਦਾ ਹੈ ਅਤੇ ਸਾਨੂੰ ਅਲੱਗ ਅਲੱਗ ਪ੍ਰੋਬਲਮਸ ਦੇ ਹਿਸਾਬ ਨਾਲ ਯੋਗਾ ਬਾਰੇ ਦੱਸਦੇ ਹਨ ਅਸੀਂ ਸਰੀਰਕ ਗਤੀਵਿਧੀਆਂ ਵਧਾਉਣ ਲਈ ਘਰ ਦੇ ਛੋਟੇ ਛੋਟੇ ਕੰਮ ਖੁਦ ਕਰਦੇ ਹਾਂ ਜਿਸ ਕਰਕੇ ਆਪਣਾ ਵੱਧ ਤੋਂ ਵੱਧ ਸਰੀਰਕ ਕੰਮ ਹੋਵੇ ਔਰ ਆਪਾਂ ਤੰਦਰੁਸਤ ਰਹਿ ਸਕੀਏ